ਹੈਲੋ ਵਧੀਆ ਵਧੀਆ ਅਸ਼ਨੀਤ ਆਪਣੀ ਸੁਣਾ ਮੈਂ ਵੀ ਜਸਟ ਯਾਰ ਹੁਣੇ ਫਰੀ ਹੋਈ ਸੀ ਔਫਿਸ ਤੋਂ ਆਉਣ ਕੇ ਸਹੀ ਗੱਲ ਆ ਯਾਰ ਬਹੁਤ ਠੰਡ ਆ ਉੱਪਰੋਂ ਇੰਨਾ ਕੰਮ ਹਾਂ ਯਾਰ ਬਹੁਤ ਵਧੀਆ ਆਈਡੀਆ ਆ ਤੇਰਾ ਅੱਛਾ ਹਾਂ ਹਾਂ ਬਹੁਤ ਵਧੀਆ ਯਾਰ ਆਈਡੀਆ ਤੇਰਾ ਤਾਂ ਹਾਂ ਵਧੀਆ ਆ ਕੋਈ ਨਹੀਂ ਅਸੀਂ ਇਸ 'ਤੇ ਸੋਚਦੇ ਹਾਂ ਵਿਚਾਰ ਕਰਦੇ ਹਾਂ ਫਿਰ ਦੇਖਦੇ ਹਾਂ ਆਪਾਂ ਕਰਦੇ ਹਾਂ ਸਟਾਰਟਅਪ ਹਾਂ ਹਾਂ ਚਲ ਠੀਕ ਹੈ ਬਾਏ